ਫੜਨ ਨਾਲ ਸੰਬੰਧਿਤ ਕੁਝ ਵਾਤਾਵਰਨ ਜਾਂ ਸੰਭਾਲ ਦੇ ਮੁੱਦੇ ਮੇਨ ਇਹ ਹਨ ਕਿ ਪਾਣੀ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਚੁੱਕਿਆ ਖੇਤਾਂ ਖੇਤ ਫ ਫੈਕਟਰੀਆਂ ਦਾ ਕੂੜਾ ਕਰਕਟ ਅਤੇ ਖੇਤਾਂ ਦੇ ਵਿੱਚ ਵਰਤੇ ਜਾਂਦੇ ਰਸਾਇਣਿਕ ਪਦਾਰਥ ਪਾਣੀ ਦੇ ਵਿੱਚ ਮਿਕਸ ਹੋ ਜਾਂਦੇ ਹਨ ਜਿਸ ਦੇ ਨਾਲ ਕਿ ਮੱਛੀਆਂ ਜੋ ਹੈ ਉਹ ਬਹੁਤ ਜ਼ਿਆਦਾ ਮਰ ਰਹੀਆਂ ਹਨ